ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਵਿੱਚ ਕਈ ਮੰਦਰ ਕਈ ਗੁਰਦੁਆਰੇ ਅਤੇ ਕਈ ਮਸੀਤਾਂ ਹਨ ਪੰਜਾਬ ਵਿੱਚ ਗੁਰਦੁਆਰਿਆਂ ਦੀ ਸੰਖਿਆ ਜ਼ਿਆਦਾ ਹੈ ਪੰਜਾਬ ਵਿੱਚ ਗੁਰਦੁਆਰਿਆਂ ਦੀ ਸੰਖਿਆ ਜ਼ਿਆਦਾ ਹੋਣ ਕਾਰਨ ਸਿੱਖੀ ਧਰਮ ਦੇ ਬੰਦੇ ਜ਼ਿਆਦਾ ਹਨ ਪੰਜਾਬ ਵਿੱਚ ਪ੍ਰਮੁੱਖ ਸਥਾਨ ਦਰਬਾਰ ਸਾਹਿਬ ਹੈ ਜਿਸ ਵਿੱਚ ਅ ਲੱਖਾਂ ਲੋਕ ਸ਼ਰਧਾਲੂ ਵੱਖ ਵੱਖ ਸ਼ਹਿਰਾਂ ਪ੍ਰਦੇਸ਼ਾਂ ਜਾਂ ਵੱਖ ਵੱਖ ਸ ਅਸਥਾਨਾਂ ਤੋਂ ਪੂਜਦੇ ਹਨ ਇਹ ਸਥਾਨ ਬੜਾ ਪ੍ਰਮੁੱਖ ਪਵਿੱਤਰ ਅਤੇ ਭਾਈਚਾਰਿਆਂ ਨਾਲ ਸਬੰਧਤ ਰੱਖਦਾ ਹੈ ਇਸ ਵਿੱਚ ਲੱਖਾਂ ਸ਼ਰਧਾਲੂ ਰੋਜ਼ ਫਰੀ 'ਚ ਰੋਟੀ ਛੱਕਦੇ ਹਨ ਜਿਸ ਨੂੰ ਜਿਸ ਦੇ ਰੂਪ ਵਿੱਚ ਲੰਗਰ ਕਿਹਾ ਜਾਂਦਾ ਹੈ ਇਸ ਸਥਾਨ ਵਿੱਚ ਹਰੇਕ ਸਮਾਜ ਦੇ ਵਿਅਕਤੀ ਹਰਮੇਕ ਧਰਮ ਦੇ ਵਿਅਕਤੀ ਦਾ ਸਮਾਨ ਕੀਤਾ ਜਾਂਦਾ ਹੈ ਇਸ ਥ ਸਥਾਨ ਵਿੱਚ ਕਈ ਲੱਖਾਂ ਸ਼ਰਧਾਲੂਆਂ ਆਪਣੇ ਜਜ ਇੱਛਾ ਪ੍ਰਗਟ ਕਰਦੇ ਹਨ ਜਿਸ ਦੀ ਪੂਰਤੀ ਇੱਥੇ ਅਰਦਾਸ ਕਰਦੇ ਹਨ ਅਤੇ ਇਹ ਸਥਾਨ ਉਸ ਦੀ ਪ੍ਰਾਪਤੀ ਲਈ ਹਮੇਸ਼ਾ ਅੱਗੇ ਹੁੰਦਾ ਹੈ